ਵੈਸੇ ਤਾਂ ਸ਼ਹੀਦ ਭਗਤ ਸਿੰਘ ਨਗਰ ਵਿੱਚ ਬਹੁਤ ਹੀ ਮਨੋਰੰਜਨ ਗਤੀਵਿਧੀਆਂ ਲੱਗਦੀਆਂ ਹਨ ਆਪਾਂ ਉਹਨਾਂ ਵਿੱਚੋਂ ਅੱਜ ਇੱਕ ਮਹੱਤਵਪੂਰਨ ਗਤੀਵਿਧੀਆਂ ਮਨੋਰੰਜਨ ਬਾਰੇ ਗੱਲ ਕਰਾਂਗੇ ਜੋ ਕਿ ਬਲਾਚੌਰ ਦੇ ਵਿੱਚ ਬਾਬਾ ਵਿਸ਼ਵਕਰਮਾ ਜੀ ਦੇ ਮੰਦਰ 'ਤੇ ਹਰੇਕ ਸਾਲ ਦਿਵਾਲੀ ਦੇ ਦੂਜੇ ਦਿਨ ਪ੍ਰੋਗਰਾਮ ਹੁੰਦਾ ਹੈ ਇਸ ਦਿਨ ਇਹ ਪ੍ਰੋਗਰਾਮ ਦੇ ਵਿੱਚ ਹਜ਼ਾਰਾਂ ਹੀ ਗਿਣਤੀ ਵਿੱਚ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ ਅਤੇ ਪ੍ਰੋਗਰਾਮ ਦਾ ਅਨੰਦ ਮਾਣਦੇ ਹਨ ਇਸ ਪ੍ਰੋਗਰਾਮ ਦੇ ਵਿੱਚ ਹਰੇਕ ਪ੍ਰਕਾਰ ਦੀ ਦੁਕਾਨ ਹਰੇਕ ਪ੍ਰਕਾਰ ਦਾ ਖਾਣ ਪੀਣ ਦਾ ਸਮਾਨ ਹਰੇਕ ਪ੍ਰਕਾਰ ਦਾ ਲੰਗਰ ਮੰਦਰ ਵੱਲੋਂ ਲਗਵਾਇਆ ਜਾਂਦਾ ਹੈ ਇਹਦੇ ਵਿੱਚ ਇਹ ਕਿਸੇ ਕਿਸਮ ਦੀ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਇਹ ਜਗ੍ਹਾ ਛਿੰਝ ਪ੍ਰਕਾਰ ਮਨਾਈ ਜਾਂਦੀ ਹੈ ਜਿਵੇਂ ਛਿੰਝ ਲੱਗਦੀ ਹੈ ਅਤੇ ਮਨੋਰੰਜਨ ਗਤੀਵਿਧੀਆਂ ਦੇ ਵਿੱਚ ਇੱਥੇ ਬਹੁਤ ਹੀ ਦੂਰ ਦੂਰ ਤੋਂ ਲੋਕ ਆਉਂਦੇ ਹਨ ਇੱਕ ਸ ਮੋਰਨਿੰਗ ਅੱਠ ਵਜੇ ਤੋਂ ਲੈ ਕੇ ਸ਼ਾਮ ਦੇ ਨੌਂ ਵਜੇ ਤੱਕ ਇਹ ਮੇਲਾ ਭਰਪੂਰ ਭਰਿਆ ਰਹਿੰਦਾ ਹੈ ਇਹ ਬਲਾਚੋਰ ਦੇ ਬਾਬਾ ਵਿਸ਼ਵਕਰਮਾ ਮੰਦਿਰ ਦੇ ਬਾਹਰ ਲੱਗਦਾ ਹੈ